ਪੰਜ ਲੱਖ ਛੱਤੀ ਹਜ਼ਾਰ ਨੌ ਸੌ ਨੜਿਨਵੇਂ ਸੱਤ ਲੱਖ ਚਾਰ ਹਜ਼ਾਰ ਸੱਤ ਸੌ ਬਿਆਸੀ ਨੌ ਲੱਖ ਛੱਤੀ ਹਜ਼ਾਰ ਦੋ ਸੌ ਇੱਕ ਲੱਖ ਚਾਲੀ ਹਜ਼ਾਰ ਪੰਜ ਸੌ ਦੋ ਲੱਖ ਇਕੱਤੀ ਹਜ਼ਾਰ ਛੇ ਸੌ ਛਿਆਨਵੇਂ